ਅੱਜ ਕੱਲ੍ਹ ਲਵੈਂਡਰ ਪਿੰਕ ਅਨੀਅਨ ਪਿੰਕ ਹਰੇ ਗੋਲਡਨ ਬਰਾਊਨ ਸੂਟਾਂ ਦੇ ਰੰਗਾਂ ਦਾ ਬਹੁਤ ਫੈਸ਼ਨ ਹੈ ਅਤੇ ਨਾਲ ਹੀ ਲੇਸ ਵਾਲੀ ਸੂਟ ਕਢਾਈ ਵਾਲੇ ਸੂਟ ਧਾਗੇ ਦੀ ਕਢਾਈ ਹੱਥ ਦੀ ਕਢਾਈ ਪੈਚ ਵਰਕ ਸਿਲਕ ਦੇ ਸੂਟਾਂ ਦੇ ਬਹੁਤ ਜ਼ਿਆਦਾ ਪਸੰਦ ਡਿਜ਼ਾਇਨ ਪਸੰਦ ਆ ਰਹੇ ਹਨ ਧੰਨਵਾਦ